ਵਿਆਹ ਦੇ ਸਮੇਂ ਲਾੜੀ ਨੂੰ ਪਰਿਵਾਰ ਵਾਲੇ ਬਰਤਨ ਗਹਿਣਾ ਕੱਪੜਾ ਫਰਨੀਚਰ ਅਤੇ ਕਈ ਹੋਰ ਜ਼ਰੂਰਤ ਦੀਆਂ ਵਸਤੂਆਂ ਦਿੰਦੇ ਹਨ ਇਹ ਵਸਤੂਆਂ ਅਸਲ ਵਿੱਚ ਉਹਨਾਂ ਦਾ ਪਿਆਰ ਹੁੰਦਾ ਹੈ ਜੋ ਉਸ ਦੇ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਸਹਾਈ ਹੁੰਦਾ ਹੈ ਇਸ ਨੂੰ ਅਸੀਂ ਦਾਜ ਨਹੀਂ ਕਹਿ ਸਕਦੇ ਇਹ ਪਿਆਰ ਦਾ ਦੂਜਾ ਰੂਪ ਹੁੰਦਾ ਹੈ ਪਰ ਜਦੋਂ ਇਹ ਪਿਆਰ ਮੰਗ ਦੇ ਰੂਪ ਵਿੱਚ ਖੜ੍ਹਾ ਹੁੰਦਾ ਹੈ ਤਾਂ ਇਸਨੂੰ ਦਾਜ ਕਿਹਾ ਜਾਂਦਾ ਹੈ ਜੋ ਕਿ ਇੱਕ ਗਰੀਬ ਲਈ ਬਹੁਤ ਔਖਾ ਹੈ ਲੋਕ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਵਿਆਜ 'ਤੇ ਪੈਸਾ ਚੁੱਕ ਕੇ ਆਪਣੀਆਂ ਧੀਆਂ ਲਈ ਗਹਿਣਾ ਕੈਸ਼ ਗੱਡੀਆਂ ਅਤੇ ਫਰਨੀਚਰ ਦਿੰਦੇ ਹਨ ਪਹਿਲਾਂ ਵਿਆਹ ਗਲੀਆਂ ਅਤੇ ਪਾਰਕਾਂ ਵਿੱਚ ਕੀਤੇ ਜਾਂਦੇ ਸੀ ਹੁਣ ਵਿਆਹ ਮਹਿੰਗੇ ਮਹਿੰਗੇ ਹੋਟਲਾਂ ਅਤੇ ਪੈਲਸਾਂ ਵਿੱਚ ਕੀਤੇ ਜਾਂਦੇ ਹੈ ਮਾਂ ਬਾਪ ਤੋਂ ਕਿੰਨਾ ਮਾਂ ਬਾਪ ਤੋਂ ਬਿਨਾਂ ਮਾਮੇ ਚਾਚੇ ਤਾਏ ਸਭ ਨੂੰ ਖੁਸ਼ ਕੀਤਾ ਜਾਂਦਾ ਹੈ ਅਤੇ ਵਾਧੂ ਦਾ ਦਿਖਾਵਾ ਦਾਜ ਦਾ ਇੱਕ ਵੱਖਰਾ ਰੂਪ ਬਣ ਗਿਆ ਹੈ ਦਾਜ ਸਮਾਜ ਲਈ ਕੋਹੜ ਦਾ ਰੂਪ ਹੈ